ਮੇਰਾ ਪਰਿਵਾਰ ਮੇਰੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਅਤੇ ਉਹਨਾਂ ਦੇ ਨਾਲ ਬਿਤਾਇਆ ਹੋਇਆ ਸਮਾਂ ਮੈਨੂੰ ਹਮੇਸ਼ਾ ਯਾਦ ਰ ਆਉਂਦਾ ਹੈ ਅਤੇ ਹਮੇਸ਼ਾ ਹੀ ਯਾਦ ਰਹੇਗਾ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਮੈਨੂੰ ਮਨੋਰੰਜਨ ਸਭ ਤੋਂ ਵੱਧ ਪਸੰਦ ਹੈ ਕਿਉਂਕਿ ਜਦੋਂ ਤੁਸੀਂ ਪਰਿਵਾਰ ਦੇ ਨਾਲ ਕੁਝ ਖੇਡਦੇ ਹੋ ਕੁਝ ਗੱਲਾਂ ਕਰਦੇ ਹੋ ਤਾਂ ਤੁਹਾਡੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ ਮੇਰੇ ਅਨੁਸਾਰ ਮੈਂ ਸਭ ਤੋਂ ਵੱਧ ਜ਼ਿਆਦਾ ਪਸੰਦ ਕਰਦੀ ਹਾਂ ਕਿ ਮੈਂ ਆਪਣੀ ਮਾਤਾ ਪਿਤਾ ਆਪਣੀ ਫੈ ਪਰਿਵਾਰ ਭੈਣਾਂ ਅਤੇ ਭਰਾਵਾਂ ਨਾਲ ਆਪਣਾ ਸਭ ਤੋਂ ਵੱਧ ਸਮਾਂ ਬਿਤਾਵਾਂ ਜਦੋਂ ਅਸੀਂ ਕੁਛ ਵੀ ਮਲ ਕਿ ਮਨੋਰੰਜਨ ਕਰਨਾ ਹੁੰਦਾ ਹੈ ਤਾਂ ਅਸੀਂ ਸਾਰੇ ਸਾਰੇ ਜੀਅ ਘਰ ਦੇ ਜੀਅ ਬੈਠ ਕੇ ਚਿੜੀ ਉੱਡ ਕਾਂ ਉੱਡ ਇਹ ਸਭ ਖੇਡਾਂ